ਹੈਲੋ ਤੁਸੀਂ ਸਵਿਕੀ ਤੋਂ ਬੋਲ ਰਹੇ ਜੀ ਹਾਂਜੀ ਮੈਂ ਨਾ ਤੁਹਾਡੇ ਕੋਲ ਕੁਛ ਖਾਣੇ ਦਾ ਔਡਰ ਕੀਤਾ ਸੀ ਜਿਸ ਦੇ ਵਿੱਚ ਬਰਫੀ ਗੁਲਾਬ ਜਾਮਨ ਰਸਗੁੱਲੇ ਸਮੋਸੇ ਕੁਛ ਪੀਜ਼ਾ ਔਡਰ ਕੀਤਾ ਸੀ ਤੁਹਾਡੇ ਕੋਲ ਮੈਂ ਇਹ ਕੱਲ੍ਹ ਦਾ ਆਡਰ ਕੀਤਾ ਹੋਇਆ ਜੀ ਅਤੇ ਤੁਸੀਂ ਇਹ ਮੈਨੂੰ ਅੱਜ ਜ਼ਰੂਰ ਭੇਜ ਦਿਓ ਅਤੇ ਤੁਹਾਡੇ ਇੱਥੇ ਨਗਦ ਭੁਗਤਾਨ ਦੀ ਸਥਿਤੀ ਹੈਗੀ ਹੈ ਮੈਨੂੰ ਦੱਸ ਦਿਓ ਕਿਉਂਕਿ ਮੈਂ ਔਨਲਾਈਨ ਪੇਅ ਨਹੀਂ ਕਰ ਸਕਦਾ ਤੁਸੀਂ ਮੇਰਾ ਔਡਰ ਭੇਜ ਦਿਓ ਮੈਂ ਤੁਹਾਡੇ ਬੰਦੇ ਨੂੰ ਨਗਦ ਪੈਸੇ ਦੇ ਦਿਆਂਗਾ ਜੇਕਰ ਨਹੀਂ ਤਾਂ ਤੁਸੀਂ ਕਿਰਪਾ ਕਰਕੇ ਇਹ ਮੇਰਾ ਔਡਰ ਰੱਦ ਕਰ ਦਿਓ ਕਿਉਂਕਿ ਮੇਰੇ ਕੋਲ ਔਨਲਾਈਨ ਦੀ ਹੈ ਨਹੀਂ ਆ ਸਥਿਤੀ